ਮੈਂ ਇੱਕ ਕੰਪਿਊਟਰ ਪ੍ਰੋਗਰਾਮਿੰਗ ਹਾਂ ਇਸ ਲਈ ਮੇਰੇ ਕੋਲ ਕੋਈ ਵਿਅਕਤੀਗਤ ਕਾਰੋਬਾਰ ਨਹੀਂ ਹੈ ਪਰ ਜੇ ਤੁਸੀਂ ਪੁੱਛ ਰਹੇ ਹੋ ਹੀ ਪੋਰਟਲੀਫ ਦੇ ਕਾਰੋਬਾਰ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਹਨ ਤਾਂ ਇਹ ਸਵਾਲ ਸੰਬੰਧਤ ਖੇਤਰ ਵਿੱਚ ਹੋਰ ਲਾਭ ਜਾਂ ਵਿਕਾਸ ਦੀਆਂ ਸੰਭਾਵਨਾ ਨੂੰ ਖੋਲ੍ਹਦਾ ਹੈ ਪੋਲਟਰੀ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਕੁਛ ਵਧੀਆ ਸਲਾਹ ਵਿੱਚ ਸ਼ਾਮਲ ਹਨ ਉਦਪਾਦਕਾਂ ਦੀ ਵਿਵਿਧਤਾ ਸਿਰਫ ਮੁਰਗੀਆਂ ਦੀ ਚਿਕਨ ਸੇਲ ਕਰਨਾ ਹੀ ਨਹੀਂ ਸਗੋਂ ਅੰਡੇ ਫਰੀਜਡ ਫੂਡ ਜਾਂ ਅਨੁਕੂਲ ਖਾਣ ਪੀਣ ਦੀਆਂ ਚੀਜ਼ਾਂ ਪੇਸ਼ ਕਰਨ ਦਾ ਵੀ ਵਿੱਕਾ ਵਿਚਾਰ ਕੀਤਾ ਜਾ ਸਕਦਾ ਹੈ ਬਾਓਲੋਜੀਕਲੀ ਅਤੇ ਆਰ ਗਨ ਆਰਗੈਨਿਕਸ ਫਾਰਮਿੰਗ ਜੇ ਕੋਈ ਕੁਦਰਤੀ ਜਾਂ ਆਰਗੈਨਿਕਸ ਪ੍ਰੋਡਕਟ ਪੇਸ਼ ਕਰਦਾ ਤਾਂ ਇਸ ਨਾਲ ਮੁਹੱਈਆ ਕੀਤੀ ਜਾ ਰਹੀ ਸੇਵਾ ਦੀ ਖਾਸੀਅਤ ਵੱਧ ਜਾਣ ਵੱਧ ਸਕਦੀ ਹੈ ਅਤੇ ਉਪਭੋਗਤਾ ਦੀ ਚਾਹਤ ਬਡ ਜਾਂਦੀ ਬਡ ਸਕਦੀ ਹੈ ਮਾਰਕਟਿੰਗ ਅਤੇ ਵਿਕਰੀ ਓਨਲਾਈਨ ਮਾਰਕਟਿੰਗ ਪਲੇਸ ਸਿੱਧੇ ਗਾਹਕਾਂ ਦੇ ਨਾਲ ਸੰਪਰਕ ਜਾਂ ਰੈਸਟੋਰੈਂਟ ਹੋਟਲਾਂ ਦੀ ਸਾਂਝੇਦਾਰੀ ਦੇ ਨਾਲ ਵਪਾਰਕ ਵਾਧਾ ਹੈ ਜੇ ਤੁਸੀਂ ਹੋਰ ਵਿਚਾਰ ਕਰ ਰਹੇ ਹੋ ਤਾਂ ਪੋਟਰੀ ਫਾਰਮ ਦੇ ਨਾਲ ਹੋਰ ਕਿਹੜੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਹਨ ਤਾਂ ਉਹ ਇਸ ਖੇਤਰ ਨਾਲ